ਅਸੀਂ ਫੁੱਟਬਾਲ ਦੀ ਖੇਡ ਖੇਡਦੇ ਹਾਂ ਅਤੇ ਇਸ ਖੇਡ ਨੂੰ ਖੇਡਣ ਦੇ ਲਈ ਅਸੀਂ ਜੋ ਪਿੰਡ ਦੇ ਸਕੂਲ ਦੀ ਗਰਾਊਂਡ ਹੈ ਓਸ ਗਰਾਊਂਡ ਦੇ ਵਿੱਚ ਇਹ ਖੇਡ ਨੂੰ ਅਸੀਂ ਖੇਡਦੇ ਹਾਂ ਇਸ ਖੇਡ ਨੂੰ ਅਸੀਂ ਆਪਣੀ ਜਮਾਤੀਆਂ ਦੇ ਨਾਲ ਆਪਣੇ ਪਿੰਡ ਦੇ ਜੋ ਛੋਟੇ ਜਾਂ ਵੱਡੀ ਉਮਰ ਦੇ ਮੁੰਡੇ ਨੇ ਓਹਨਾਂ ਖਿਡਾਰੀਆਂ ਦੇ ਨਾਲ ਅਸੀਂ ਖੇਡਦੇ ਹਾਂ ਓਸੇ ਗਰਾਊਂਡ ਦੇ ਵਿੱਚ ਹੀ ਓਸੇ ਪਿੰਡ ਦੇ ਮੁੰਡੇ ਹੁੰਦੇ ਨੇ ਅਤੇ ਓਸ ਸਕੂਲ ਦੇ ਵਿੱਚ ਜ਼ਿਆਦਾਤਰ ਪੜ੍ਹਦੇ ਨੇ ਅਤੇ ਜੇ ਲੋਕਾਂ ਨੇ ਇਸ ਖੇਡ ਨੂੰ ਖੇਡਣਾ ਵਾ ਓਹਨਾਂ ਨੂੰ ਵੀ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਹੀ ਫੁੱਟਵਾਲ ਖੇਡਣੀ ਪਏਗੀ ਜਾਂ ਉਹ ਪਿੰਡ ਦੇ ਕਿਸੇ ਵੀ ਖਾਲੀ ਥਾਂ ਦੇ ਉੱਤੇ ਜੋ ਚਾਹੇ ਛੋਟਾ ਵਾ ਚਾਹੇ ਵੱਡਾ ਹੈ ਮੈਦਾਨ ਓਹਦੇ ਵਿੱਚ ਓਹ ਖੇਡ ਸਕਦੇ ਨੇ ਆਪਣੇ ਪਿੰਡ ਦੀ ਗਰਾਊਂਡ ਵਿੱਚ ਵੀ ਖੇਡ ਸਕਦੇ ਨੇ ਫੁੱਟਵਾਲ ਨੂੰ ਉਹ ਹਾਕੀ ਦੇ ਮੈਦਾਨ ਦੇ ਵਿੱਚ ਵੀ ਖੇਡ ਸਕਦੇ ਨੇ ਜਾਂ ਇਸ ਤੋਂ ਇਲਾਵਾ ਓਹ ਆਪਣੇ ਸ਼ਹਿਰਾਂ ਵਿੱਚ ਜਾਂ ਘਰਾਂ ਵਿੱਚ ਥੋੜ੍ਹੀ ਬਹੁਤੇ ਥਾਂ ਬਣਾ ਕੇ ਓਸ ਥਾਂ ਦੇ ਵਿੱਚ ਇਸ ਖੇਡ ਨੂੰ ਖੇਡ ਸਕਦੇ ਨੇ ਇਹ ਖੇਡ ਬੜੀ ਵਧੀਆ ਹੈ ਸ਼ਾਨਦਾਰ ਹੈ ਇੰਟਰਨੈਂਸ਼ਨਲ ਪੱਧਰ ਦੀ ਖੇਡ ਹੈ ਜਿਹਦੇ ਵਿੱਚ ਵੱਡੇ ਵੱਡੇ ਜੋ ਖਿਡਾਰੀ ਨੇ ਓਹਨਾਂ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੋਈ ਹੈ